ਮੈਂ ਆਪਣੇ ਘਰ ਫ਼ਲਾਂ ਦੇ ਬੂਟੇ ਅਤੇ ਸਬਜ਼ੀਆਂ ਉਗਾਉਂਦੀ ਰਹਿੰਦੀ ਹਾਂ ਸਬਜ਼ੀਆਂ ਮੈਂ ਗਰਮੀ ਅਤੇ ਸਰਦੀ ਦੇ ਮੌਸਮ ਅਨੁਸਾਰ ਲਗਾਉਂਦੀ ਹਾਂ ਜਿਵੇਂ ਕਿ ਹੁਣ ਸਰਦੀ ਦਾ ਮੌਸਮ ਚੱਲ ਰਿਹਾ ਹੈ ਮੈਂ ਘਰ ਵਿੱਚ ਪਾਲਕ ਧਨੀਆ ਗੋਭੀ ਗਾਜਰਾਂ ਆਦਿ ਬੀਜੀਆਂ ਹੈ ਮੈਨੂੰ ਮੈਂ ਆਪਣੇ ਘਰ ਸਬਜ਼ੀਆਂ ਜੋ ਬੀਜੀਆਂ ਹਨ ਉਹ ਬਿਨਾਂ ਕਿਸੇ ਕੈਮੀਕਲ ਦੀ ਵਰਤੋਂ ਤੋਂ ਹੈ ਮੈਂ ਘਰ ਦੀ ਦੇਸੀ ਖਾਦ ਨਾਲ਼ ਉਹ ਸਬਜ਼ੀਆਂ ਬਣਾਈਆਂ ਹਨ ਮੈਨੂੰ ਇਸ ਤੋਂ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਅਗਰ ਆਪਾਂ ਮਿਹਨਤ ਕਰਾਂਗੇ ਤਾਂ ਸਾਨੂੰ ਚੰਗੀ ਚੀਜ਼ ਦਾ ਫ਼ਲ ਹੀ ਮਿਲੇਗਾ